ਪੰਜ ਅਕਤੂਬਰ ਉੱਨੀ ਸੌ ਨੱਬੇ ਦਸ ਫਰਵਰੀ ਉੱਨੀ ਸੌ ਅਠਾਨਵੇਂ ਬਾਰ੍ਹਾਂ ਜਨਵਰੀ ਉੱਨੀ ਸੌ ਇਕਾਨਵੇਂ ਚੌਦ੍ਹਾਂ ਦਸੰਬਰ ਉੱਨੀ ਸੌ ਸਤਾਸੀ ਗਿਆਰ੍ਹਾਂ ਅਗਸਤ ਦੋ ਹਜ਼ਾਰ ਦਸ